ਟੈਕਨੋਲਜੀ ਦੀ ਵਰਤੋਂ ਕਰਦੇ ਸਮੇਂ ਸਾਡੇ ਬਜੁਰਗਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਸੰਭਵ ਤਾਂ ਹੋ ਸਕਦਾ ਹੈ ਪਰ ਸਾਨੂੰ ਅੱਜ ਦੇ ਯੁਵਾ ਨੂੰ ਕੁਛ ਕਰਨਾ ਪਵੇਗਾ ਕਿਉਂਕਿ ਸਾਡੀ ਟੈਕਨੋਲਜੀ ਬਹੁਤ ਹੀ ਜ਼ਿਆਦਾ ਵੱਧ ਰਹੀ ਹੈ ਸਾਡੇ ਬਜੁਰਗਾਂ ਦਾ ਘੱਟ ਪੜ੍ਹੇ ਲਿਖੇ ਹੋਣਾ ਵੀ ਉਨ੍ਹਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਅੱਜ ਕੱਲ੍ਹ ਕਈ ਸਾਰੀਆਂ ਟੈਕਨੋਲਜੀ ਆ ਗਈਆਂ ਹਨ ਜਿਸ ਨਾਲ ਉਨ੍ਹਾਂ ਦੀ ਸਹਾਇਤਾ ਨਾਲ ਅਸੀਂ ਟੈਕਨੋਲਜੀ ਦੀ ਵਰਤੋਂ ਕਰਨ ਲਈ ਇਸਤੇਮਾਲ ਕਰ ਸਕਦੇ ਹਾਂ ਸਾਡੇ ਸਹਿਰਾਂ ਅਤੇ ਪੇਂਡੂ ਨਿਵਾਸਾਂ ਵਿੱਚ ਕਈ ਸੰਸਥਾਵਾਂ ਵੀ ਖੁੱਲ੍ਹ ਗਈਆਂ ਹਨ ਜਿਸ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਅਸੀਂ ਕਿਵੇਂ ਟੈਕਨੋਲਜੀ ਦੀ ਵਰਤੋਂ ਕਰ ਸਕਦੇ ਹਾਂ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਇਹ ਵੀ ਦੱਸਿਆ ਜਾਂਦਾ ਹੈ ਕਿ ਟੈਕਨੋਲਜੀ ਦੀ ਵਰਤੋਂ ਕਰਦੇ ਸਮੇਂ ਤੁਸੀਂ ਕੀ ਕੀ ਇਸਤੇਮਾਲ ਕਰ ਸਕਦੇ ਹੋ ਅੱਜ ਕੱਲ੍ਹ ਤਾਂ ਫ਼ੋਨ ਦੀ ਸਹਾਇਤਾ ਨਾਲ ਵੀ ਅਸੀਂ ਕਈ ਸਾਰੀਆਂ ਸੰਸਥਾਵਾਂ ਬਾਰੇ ਜਾਣਕਾਰੀ ਲੱਭ ਸਕਦੇ ਹਾਂ ਉਸ ਵਿੱਚ ਸਾਰੇ ਬਟਨ ਸਭ ਕੁਛ ਦੱਸਿਆ ਹੋਇਆ ਹੈ ਕਿ ਕਿਵੇਂ ਅਸੀਂ ਟੈਕਨੋਲਜੀ ਦੀ ਵਰਤੋਂ ਕਰ ਸਕਦੇ ਹਾਂ ਅਤੇ ਸਾਰਾ ਕੁਛ ਦੱਸਿਆ ਜਾਂਦਾ ਹੈ